ਭਾਰਤ ਇੱਕ ਕਾਫੀ ਵੱਡਾ ਦੇਸ਼ ਹੈ ਜਿਸ ਵਿੱਚ ਲੋਕ ਪ੍ਰਦੇਸ਼ਾਂ ਤੋਂ ਵੀ ਭਾਰਤ ਨੂੰ ਘੁੰਮਣ ਆਉਂਦੇ ਹਨ ਅਤੇ ਭਾਰਤ ਵਿੱਚ ਅਰਬਾਂ ਦੀ ਗਿਣਤੀ ਵਿੱਚ ਲੋਕ ਰਹਿੰਦੇ ਹਨ ਪਰ ਦੁਖ ਦੀ ਗੱਲ ਇਹ ਹੈ ਕਿ ਜਿਸ ਹਿਸਾਬ ਨਾਲ ਲੋਕ ਭਾਰਤ ਵਿੱਚ ਵੱਧ ਰਹੇ ਹਨ ਉਸ ਹਿਸਾਬ ਨਾਲ ਕੰਮ ਨਹੀਂ ਵੱਧ ਰਿਹਾ ਕਈ ਲੋਕ ਤਾਂ ਚੰਗੀ ਸ਼ਿਕਸ਼ਾ ਪ੍ਰਾਪਤ ਕਰਕੇ ਵੀ ਨੌਕਰੀਆਂ ਨਾ ਨਹੀਂ ਲੈ ਸਕੇ ਅਤੇ ਉਹ ਬੇਰੁਜ਼ਗਾਰ ਘੁੰਮ ਰਹੇ ਹਨ ਬੇਰੁਜ਼ਗਾਰੀ ਭਾਰਤ ਲਈ ਚੁਣੌਤੀ ਬਣ ਗਈ ਹੈ ਜਿਸ ਕਰਕੇ ਪੜ੍ਹੇ ਲਿਖੇ ਵਿਦਿਆਰਥੀ ਨੂੰ ਵੀ ਨੌਕਰੀ ਨਹੀਂ ਮਿਲ ਰਹੀ ਇਸ ਦਾ ਮਹੱਤਵਪੂਰਨ ਇਸਦਾ ਮਹੱਤਵਪੂਰਨ ਕਾਰਨ ਵੱਧਦੀ ਆਬਾਦੀ ਵੀ ਹੈ ਜਿਸ ਨੂੰ ਸਾਨੂੰ ਕਾਬੂ ਵਿੱਚ ਕਰਨਾ ਚਾਹੀਦਾ ਹੈ ਅਤੇ ਬੇਰੁਜ਼ਗਾਰੀ ਨੂੰ ਵੀ ਕਾਬੂ ਕਰਨ ਲਈ ਸਰਕਾਰ ਨੇ ਕਾਫੀ ਯੋਜਨਾ ਬਣਵਾਈਆਂ ਹਨ ਜਿਵੇਂ ਕਿ ਬੇਰੁਜ਼ਗਾਰੀ ਭੱਤਾ ਯੋਜਨਾ ਹੋ ਗਈ ਜਿਸ ਵਿੱਚ ਸਰਕਾਰ ਬੇਰੁਜ਼ਗਾਰਾਂ ਨੂੰ ਪੱਚੀ ਸੌ ਰੁਪਏ ਮਹੀਨਾ ਪੈਸੈ ਦਿੰਦੀ ਹੈ ਜਿਸ ਜਿਸ ਨਾਲ ਲੋਕ ਆਪਣਾ ਕੰਮ ਸ਼ੁਰੂ ਕਰ ਸਕਣ ਨਾਲ ਅਤੇ ਬੇਰੁਜ਼ਗਾਰੀ ਤੋਂ ਬੇ ਬੇਰੁਜ਼ਗਾਰ ਬੇ ਬੇਰੁਜ਼ਗਾਰੀ ਨੂੰ ਘਟਾਇਆ ਜਾ ਸਕੇ ਇਹ ਕਾਫੀ ਚੰਗੀ ਹੱਲ ਹੈ ਕਿ ਸਰਕਾਰ ਸਾਨੂੰ ਆਪ ਮੌਕਾ ਦੇ ਰਹੀ ਹੈ ਅਤੇ ਕਈ ਲੋਕ ਇਸ ਦਾ ਬਹੁਤ ਫਾਇਦਾ ਵੀ ਉਠਾ ਰਹੇ ਹਨ ਜਿਸ ਨਾਲ ਕਈ ਪ੍ਰਤੀਸ਼ਤ ਬੇਰੁਜ਼ਗਾਰਾਂ ਦੀ ਸਮੱਸਿਆ ਵੀ ਘੱਟ ਹੋ ਗਈ ਹੈ ਸਾਨੂੰ ਇਸ ਬੇਰੁਜ਼ਗਾਰੀ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਸਰਕਾਰ ਨੂੰ ਵੀ ਕਈ ਨਵੀਂ ਫੈਕਟਰੀਆਂ ਖੁੱਲ੍ਹਵਾ ਦੇਣੀ ਚਾਹੀਦੀਆਂ ਹਨ ਜਿਸ ਨਾਲ ਬੇਰੁਜ਼ਗਾਰੀ ਵੀ ਘੱਟ ਹੋ ਸਕੇ ਅਤੇ ਬੇਰੁਜ਼ਗਾਰਾਂ ਅਤੇ ਬੇਰੁਜ਼ਗਾਰਾਂ ਨੂੰ ਵੀ ਰੁਜ਼ਗਾਰ ਮਿਲ ਸਕੇ